ਹਾਂਜੀ ਅੱਜ ਦਾ ਦੌਰ ਜਿਹੜਾ ਆ ਫੈਸ਼ਨ ਅਤੇ ਦਿਖਾਵੇ ਦਾ ਦੌਰ ਹੈ ਲੋਕਾਂ ਵਿੱਚ ਵਿਖਾਵੇ ਦੀ ਜਿਹੜੀ ਹੋੜ ਇੰਨੀ ਕੁ ਜ਼ਿਆਦਾ ਲੱਗੀ ਹੈ ਕਿ ਉਹ ਵੱਧ ਤੋਂ ਵੱਧ ਜਿਹੜਾ ਆ ਦਿਖਾਵਾ ਕਰਨ ਦੇ ਵਿੱਚ ਰੁੱਝੇ ਹੋਏ ਨੇ ਹਾਂਜੀ ਸਾਡੇ ਖੇਤਰ ਵਿੱਚ ਖ਼ਾਸ ਬੁਣਾਈ ਸਿਲਾਈ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਜਿਵੇਂ ਵੱਖਰੇ ਵੱਖਰੇ ਡਿਜ਼ਾਇਨਾਂ ਦੇ ਸੂਟ ਡਰੈੱਸਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਆਪਾਂ ਵੇਖਦੇ ਹਾਂ ਕਿ ਬੁਟੀਕਾਂ ਵਾਲੇ ਟੇਲਰ ਜਿਹੜੇ ਨੇ ਉਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੱਖ ਵੱਖ ਤਰ੍ਹਾਂ ਦੇ ਫੈਬਰਿਕ ਲੈ ਕੇ ਠੀਕ ਹੈ ਕੱਪੜਾ ਕੱਟ ਕੇ ਵੱਖ ਵੱਖ ਡਿਜ਼ਾਇਨਾਂ ਦਾ ਜਿਹੜਾ ਆ ਡਿਜ਼ਾਇਨ ਤਿਆਰ ਕਰਦੇ ਨੇ ਫਿਰ ਉਹ ਸਿਲਾਈ ਕਰਕੇ ਪੂਰਾ ਜਿਹੜਾ ਆ ਪੀਸ ਤਿਆਰ ਕਰਦੇ ਨੇ ਕੋਈ ਕਈ ਜਿਹੜੇ ਨੇ ਰਿਵਾਇਤੀ ਕੱਪੜੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਚਲਦੇ ਨੇ ਸਲਵਾਰ ਕਮੀਜ਼ ਪਟਿਆਲਾ ਸਲਵਾਰ ਕੁੜਤਾ ਪਜਾਮਾ ਫਰਾਕ ਸਾੜੀ ਅਤੇ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਕੱਪੜੇ ਨੇ ਤਿਆਰ ਕੀਤੇ ਜਾਂਦੇ ਹਨ ਅਤੇ ਮੈਂ ਵੀ ਕਈ ਵਾਰ ਏ ਇਹਨਾਂ ਦੇ ਹੱਥ ਅਜਮਾਈ ਕੀਤੀ ਹੈ ਮੈਂ ਵੀ ਇਹ ਜਿਹੜੇ ਰਿਵਾਇਤੀ ਕੱਪੜੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਸਾਡੇ ਸ਼ਹਿਰ ਦੇ ਵਿੱਚ ਸਵੈਟਰਾਂ ਦੀ ਬੁਣਾਈ ਵੱਖ ਵੱਖ ਤਰ੍ਹਾਂ ਦੀ ਉੱਨ ਦੇ ਨਾਲ ਕੀਤੀ ਜਾਂਦੀ ਹੈ ਇਸ ਬੁਣਾਈ ਦਾ ਕੰਮ ਘਰਾਂ ਦੇ ਵਿੱਚ ਜਨਾਨੀਆਂ ਜਿਹੜੀਆਂ ਨੇ ਸਲਾਈਆਂ ਅਤੇ ਕਰੋਸ਼ੀਏ ਦੇ ਨਾਲ ਅਤੇ ਮਸ਼ੀਨਾਂ ਦੀ ਵਰਤੋਂ ਨਾਲ ਕਰਦੀਆਂ ਨੇ ਔਰਤਾਂ ਘਰਾਂ ਦੇ ਵਿੱਚ ਹੀ ਬੈਠ ਕੇ ਕਰੋਸ਼ੀਏ ਜਾਂ ਸਲਾਈਆਂ ਦੇ ਉੱਤੇ ਵਧੀਆ ਵਧੀਆ ਨਮੂਨੇ ਦੇ ਅਤੇ ਵੱਖਰ ਵੱਖਰੇ ਰੰਗਾਂ ਦੇ ਸਵੈਟਰ ਜਿਹੜੇ ਨੇ ਬਣਾਉਂਦੇ ਨੇ ਸਵੈਟਰਾਂ ਤੋਂ ਇਲਾਵਾ ਬੱਚਿਆਂ ਦੀਆਂ ਫਰਾਕਾਂ ਟੋਪੀਆਂ ਜੁਰਾਬਾਂ ਹੱਥੀਂ ਬਣਾਈਆਂ ਜਾਂਦੀਆਂ ਨੇ ਅਤੇ ਇਸ ਤਰ੍ਹਾਂ ਉਹ ਬਣਾ ਕੇ ਜਿਹੜਾ ਨੇ ਉਹ ਵੇਚਦੇ ਨੇ ਅਤੇ ਇੱਕ ਉਹਨਾਂ ਦਾ ਇੱਕ ਬਿਜ਼ਨਸ ਦਾ ਜਿਹੜਾ ਆ ਸਾਧਨ ਬਣਿਆ ਹੋਇਆ ਕਮਾਈ ਦਾ ਜ਼ਰੀਆ ਬਣਿਆ ਹੋਇਆ ਆ ਅਤੇ ਇਸ ਤਰ੍ਹਾਂ ਸਾਡੇ ਸ਼ਹਿਰ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਸਲਾਈ ਬੁਣਾਈ ਦਾ ਕੰਮ ਜਿਹੜਾ ਆ ਮਸ਼ਹੂਰ ਆ ਅਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ